ਜੀ ਬਾਈ ਜੀ ਤੁਹਾਡਾ ਫੋਨ ਆਇਆ ਸੀਗਾ ਕਿ ਮੈਂ ਤੁਹਾਨੂੰ ਥੋਤੋ ਢਾਬੇ ਤੋਂ ਰੋਟੀ ਮੰਗਾ ਰਿਹਾ ਹਾਂ ਕੀ ਮੇਰਾ ਥ ਮੈਨੂੰ ਤੁਹਾਡਾ ਆਪਣਾ ਢਾਬੇ ਦਾ ਸਮਝ ਨਹੀਂ ਆਇਆ ਅਤੇ ਜੋ ਹਵੇਲੀ ਰੋਡ ਤੋਂ ਹਵੇਲੀ ਕਾਲਜ ਰੋਡ ਤੋਂ ਹਵੇਲੀ ਰੋਡ ਨੂੰ ਆ ਆ ਰਿਹਾ ਹੈ ਗੁਰਦੁਆਰਾ ਸ਼੍ਰੀ ਗੁਰੂ ਨਾਨ ਨਾਨਕ ਦਰਬਾਰ ਸਾਹਿਬ ਦੇ ਨਾਲ ਮੇਰਾ ਘਰ ਹਨ